ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ ਇਹਨਾਂ ਦਾ ਸਬੰਧ ਸਾਡੇ ਸੱਭਿਆਚਾਰਿਕ ਇਤਿਹਾਸਿਕ ਅਤੇ ਧਾਰਮਿਕ ਵਿਰਸੇ ਨਾਲ ਹੈ ਇਹਨਾਂ ਦੇ ਜਿਹੜੇ ਕੁਝ ਮੇਲੇ ਨੇ ਉਹ ਕੌਮੀ ਪੱਧਰ 'ਤੇ ਲੱਗਦੇ ਨੇ ਜਿਵੇਂ ਕਿ ਪੰਜਾਬ ਵਿੱਚ ਬੜੀ ਧੂਮ ਧਾਮ ਨਾਲ ਮਨਾਏ ਜਾਂਦੇ ਹਨ ਵਿਸਾਖੀ ਬਸੰਤ ਦੁਸਹਿਰਾ ਜਨਮ ਅਸ਼ਟਮੀ ਅਤੇ ਰਾਮਨੌਮੀ ਦੇ ਮੌਕਿਆਂ 'ਤੇ ਜਿਹੜੇ ਮੇਲੇ ਲੱਗਦੇ ਨੇ ਇਹ ਕੌਮੀ ਪੱਧਰ ਦੇ ਮੇਲੇ ਹਨ ਇਨ੍ਹਾਂ ਤੋਂ ਬਿਨਾਂ ਪੰਜਾਬ ਵਿੱਚ ਭਿੰਨ ਭਿੰਨ ਥਾਵਾਂ 'ਤੇ ਹੋਰ ਵੀ ਬਹੁਤ ਸਾਰੇ ਮੇਲੇ ਲੱਗਦੇ ਹਨ ਜਿਵੇਂ ਕੁਛ ਧਾਰਮਿਕ ਸਥਾਨਾਂ 'ਤੇ ਮੇਲੇ ਲੱਗਦੇ ਹਨ ਜਿਹੜੇ ਕਿ ਪੀਰਾਂ ਫ਼ਕੀਰਾਂ ਦੇਵੀ ਦੇਵਤਿਆਂ ਦੇ ਇਤਿਹਾਸਿਕ ਸਥਾਨਾਂ ਦੇ ਉੱਤੇ ਲੱਗਦੇ ਹਨ ਇਹਨਾਂ ਜਿਹੜੇ ਮੇਲਿਆਂ ਵਾ ਇਨ੍ਹਾਂ ਦਾ ਪੰਜਾਬ ਦੇ ਵਿੱਚ ਬਹੁਤ ਹੀ ਭਾਰੀ ਮਹੱਤਵ ਹੈ ਪੰਜਾਬ ਵਿੱਚ ਜਿਹੜੇ ਭਿੰਨ ਭਿੰਨ ਥਾਵਾਂ 'ਤੇ ਸਥਾਨਕ ਮੇਲੇ ਲੱਗਦੇ ਨੇ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਲੱਗਦੇ ਹਨ ਕੁਝ ਮੇਲੇ ਮਾਲਵੇ ਦੇ ਪਾਸੇ ਲੱਗਦੇ ਹਨ ਜਿੱਦਾਂ ਮਾਲਵੇ ਦੇ ਪਾਸੇ ਜਗਰ ਦਾ ਮੇਲਾ ਲੱਗਦਾ ਇਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਮੇਲਾ ਹੁੰਦਾ ਹੈ ਇਹ ਵਿੱਚ ਇਹ ਮੇਲਾ ਮਾਤਾ ਰਾਣੀ ਦੇ ਮੰਦਰ 'ਤੇ ਲੱਗਦਾ ਹੈ ਇਹਦੇ ਵਿੱਚ ਮਾਤ ਮੰਗਲਵਾਰ ਨੂੰ ਮਾਤਾ ਰਾਣੀ ਨੂੰ ਪੂਜਿਆ ਜਾਂਦਾ ਹੈ ਅਨੰਦਪੁਰ ਸਾਹਿਬ ਵਿੱਚ ਹੋਲੇ ਮੁਹ ਹੋਲੇ ਮੁਹੱਲੇ ਦਾ ਮੇਲਾ ਇਹ ਮੇਲਾ ਦੁਆਬੇ ਵਾਲੇ ਪਾਸੇ ਲੱਗਦਾ ਹੈ ਅਤੇ ਇੱਥੇ ਅਨੰਦਪੁਰ ਸਾਹਿਬ ਵਿੱਚ ਹੋਲੇ ਮੁਹੱਲੇ ਵਾਲੇ ਦਿਨ ਬਹੁਤ ਹੀ ਜ਼ਿਆਦਾ ਭੀੜ ਹੁੰਦੀ ਹੈ ਦੇਸ਼ਾਂ ਵਿਦੇਸ਼ਾਂ ਲੋਕ ਆਉਂਦੇ ਹਨ ਇਹ ਮੇਲਾ ਦੇਖਣ ਦੇ ਲਈ ਮਾਝੇ ਵਿੱਚ ਵੀ ਕਈ ਪ੍ਰਸਿੱਧ ਮੇਲੇ ਲੱਗਦੇ ਹਨ ਇਹ ਮੇਲ ਮਾਝੇ ਵਿੱਚ ਜਿਹੜੇ ਮੇਲੇ ਨੇ ਇਹ ਰਾਮਨੌਮੀ ਦੇ ਮੌਕੇ 'ਤੇ ਲੱਗਦੇ ਹਨ ਇਨ੍ਹਾਂ ਤੋਂ ਇਲਾਵਾ ਬੋ ਹੋਰ ਵੀ ਬਹੁਤ ਸਾਰੇ ਛੋਟੇ ਮੋਟੇ ਮੇਲੇ ਲੱਗਦੇ ਹਨ ਜਿਵੇਂ ਤਰਨਤਾਰਨ ਵਿੱਚ ਕਈ ਮੇਲੇ ਲੱਗਦੇ ਹਨ ਸਾਵਣ ਦੇ ਮਹੀਨੇ ਵਿੱਚ ਧੀਆਂ ਦਾ ਮੇਲਾ ਆਉਂਦਾ ਹੈ ਇਨ੍ਹਾਂ ਮੇਲਿਆਂ ਵਿੱਚ ਵਪਾਰਕ ਚੀਜ਼ਾਂ ਦੀਆਂ ਮੰਡੀਆਂ ਵੀ ਲੱਗਦੀਆਂ ਹਨ ਹੋਰ ਵੀ ਕਈ ਚੀਜ਼ਾਂ ਲੱਗਦੀਆਂ ਹਨ ਇਹਨਾਂ ਜਿਹੜੇ ਮੇਲੇ ਦੇ ਇਹਨਾਂ ਵਿੱਚ ਜਿਹੜੇ ਲੋਕ ਹੁੰਦੇ ਨੇ ਉਨਾਂ ਨੂੰ ਆਪਣੇ ਦੂਰ ਸਬੰਧੀ ਰਿਸ਼ਤੇਦਾਰਾਂ ਨੂੰ ਮਿਲਣ ਦਾ ਵੀ ਮੌਕਾ ਮਿਲਦਾ ਹੈ ਇਹਨਾਂ ਮੇਲਿਆਂ ਦੀ ਪੰਜਾਬੀ ਜੀਵਨ ਵਿੱਚ ਕਾਫ਼ੀ ਮਹਾਨਤਾ ਹੈ